ਮੇਰਾ ਖਾਸ ਸੁੰਦਰ ਜੋ ਸਥਾਨ ਹੈ ਉਹ ਮੈਸੂਰੀ ਸੀ ਉੱਥੇ ਅਸੀਂ ਕਾਫੀ ਇੰਜੋਆਏ ਕੀਤਾ ਤਿੰਨ ਚਾਰ ਦਿਨ ਆਪਾਂ ਉੱਥੇ ਰਹੇ ਹਾਂ ਔਰ ਇੱਕ ਦਿਨ ਅਸੀਂ ਟਰੈਕਿੰਗ ਲਈ ਗਏ ਸੀ ਉਹ ਟਰੈਕਿੰਗ ਅਸੀਂ ਜਦੋਂ ਕਰ ਰਹੇ ਸੀ ਉਹ ਕਾਫ਼ੀ ਟਫ ਸੀ ਠੰਢ ਪੂਰੀ ਸੀ ਜਿਹਦੇ ਕਰਕੇ ਅਸੀਂ ਸੋਚਿਆ ਕਿ ਅਸੀਂ ਵਾਪਿਸ ਚੱਲਦੇ ਹਾਂ ਲੇਕਿਨ ਜਦੋਂ ਸਾਡੀ ਟਰੈਕਿੰਗ ਪੂਰੀ ਹੋ ਗਈ ਔਰ ਉੱਪਰ ਦਾ ਜੋ ਨਜਾਰਾ ਸੀ ਉਹ ਬਹੁਤ ਹੀ ਸੋਹਣਾ ਸੀ ਜੋ ਮੇਰੇ ਦਿਮਾਗ ਦੇ ਵਿੱਚ ਹਾਲੇ ਵੀ ਚੱਲ ਰਿਹਾ ਅਸੀਂ ਅਗਰ ਮੈਸੂਰੀ ਦੀ ਗੱਲ ਕਰੀਏ ਉੱਥੇ ਸਾਨੂੰ ਪਰਬਤ ਅਤੇ ਪਹਾੜ ਜੋ ਕਾਫ਼ੀ ਉੱਚੇ ਉੱਚੇ ਰਹਿੰਦੇ ਨੇ ਸਾਨੂੰ ਉੱਥੇ ਹਿਮਾਲਿਆ ਪਰਬਤ ਦੇ ਪਹਾੜ ਦੀ ਦੂਰਬੀਨ ਦੇ ਨਾਲ ਸਾਨੂੰ ਦਿਖਾਏ ਗਏ ਸੀ ਜੋ ਇੱਕ ਦਮ ਚਮਕਦੀ ਬਰਫ਼ ਦੇ ਨਾਲ ਢੱਕੇ ਹੋਏ ਸੀ ਉਹ ਨਜਾਰਾ ਬਹੁਤ ਹੀ ਸੋਹਣਾ ਮੈਸੂਰੀ ਆਪਣੇ ਆਪ ਦੇ ਵਿੱਚ ਹੀ ਜਿਵੇਂ ਪਹਾੜਾਂ ਦੀ ਰਾਣੀ ਕਹਿੰਦੇ ਨੇ ਉਹ ਸਥਾਨ ਬਿਲਕੁਲ ਉਸ ਨਾਮ 'ਤੇ ਸਹੀ ਵੱਜਦਾ ਧੰਨਵਾਦ